ਮੇਰਾ ਮਨਪਸਿੰਦ ਭੋਜਨ ਸਰ੍ਹੋਂ ਦਾ ਸਾਗ ਅਤੇ ਮੱਕੀ ਦੀ ਰੋਟੀ ਹੈ ਮਕ ਸਰ੍ਹੋਂ ਦੇ ਸਾਗ ਵਿੱਚ ਮੱਖਣੀ ਪਾ ਕੇ ਅਤੇ ਉਸ ਵਿੱਚ ਨਾਲ਼ ਆਦੇ ਦਾ ਅਚਾਰ ਹੋਵੇ ਅਤੇ ਇਹ ਨਾਲ਼ ਲੱਸੀ ਇਹ ਮੇਰਾ ਮਨਪਸੰਦ ਭੋਜਨ ਹੈ ਮੈਂ ਉਸਨੂੰ ਆਪਣੇ ਪਰਿਵਾਰ ਵਿੱਚ ਬੈਠ ਕੇ ਸਾਰਿਆਂ ਦੇ ਨਾਲ਼ ਜਾਂ ਕੋਈ ਮੇਰਾ ਯਾਰ ਦੋਸਤ ਵੀ ਆ ਜਾਵੇ ਤਾਂ ਉਸਦੇ ਨਾਲ਼ ਸਾਰੇ ਵਧੀਆ ਤਰੀਕੇ ਨਾਲ਼ ਅਸੀਂ ਬੈਠ ਕੇ ਖਾਣਾ ਪਸੰਦ ਕਰਦੇ ਹਨ